ਹਾਂਜੀ ਮੈਂ ਖਾਣਾ ਬਣਾਉਣ ਵਿ ਕਈ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਸੀ ਜਦੋਂ ਕਰੋਨਾ ਵਾਇਰਸ ਚੱਲ ਰਿਹਾ ਸੀ ਉਦੋਂ ਮੈਂ ਘਰ ਵੇਹਲੀ ਬੈਠੀ ਇਹੀ ਕੁਛ ਬੜੀ ਤਰ੍ਹਾਂ ਦੇ ਨਾਲ ਖਾਣੇ ਬਹੁਤ ਤਰ੍ਹਾਂ ਦੇ ਖਾਣੇ ਬਣਾਉਣੇ ਅਤੇ ਮੈਂ ਇਸ ਜਦੋਂ ਮੈਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਕਿ ਕੰਪੀ ਮੁਕਾਬਲੇ ਹੋ ਰਹੇ ਹਨ ਮੈਂ ਉਹਦੇ ਵਿੱਚ ਹਿੱਸਾ ਲਿਆ ਮੈਂ ਇਸ ਦੇ ਵਿੱਚ ਸ਼ਾਹੀ ਪਨੀਰ ਬਣਾਇਆ ਜਿਸ ਨੂੰ ਲੋਕਾਂ ਨੇ ਬਹੁਤ ਹੀ ਪਸੰਦ ਕੀਤਾ ਇਸੇ ਤਰ੍ਹਾਂ ਮੈਂ ਹੋਰ ਵੀ ਕਈ ਤਰ੍ਹਾਂ ਦੇ ਖਾਣੇ ਬਣਾਏ ਕਈ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਉਹਦੇ ਵਿੱਚ ਮੈਨੂੰ ਫਸਟ ਪ੍ਰਾਈਜ ਮਿਲਿਆ ਜਦੋਂ ਮੈਨੂੰ ਫਸਟ ਮੈਨੂੰ ਪਹਿਲਾ ਦਰਜਾ ਹਾਸਲ ਹੋਇਆ ਜਦੋਂ ਪਹਿਲਾ ਦਰਜਾ ਆਇਆ ਸੀ ਤਾਂ ਲੋਕਾਂ ਨੇ ਮੈਨੂੰ ਫੋਨ ਕਰ ਕਰ ਕੇ ਰੋਜ਼ ਹੀ ਫੋਨ ਬੜੀ ਤਰ੍ਹਾਂ ਦੇ ਫੋਨ ਆਉਣੇ ਅਤੇ ਮੈਨੂੰ ਪੁੱਛਣਾ ਮੈਨੂੰ ਮ ਪਕਾਉਣ ਦੇ ਜਿਹੜੇ ਤਰੀਕੇ ਖਾਣਾ ਬਣਾਉਣ ਦਾ ਤਰੀਕਾ ਪੁੱਛਣਾ ਸਾਰਿਆਂ ਨੇ ਬਾਅਦ ਫਿਰ ਉਹਨਾਂ ਦੇ ਮੈਨੂੰ ਉਹਨਾਂ ਦੇ ਬਹੁਤ ਤਰ੍ਹਾਂ ਦਾ ਯੂਟੀਊਬ ਦੇ ਵਿੱਚ ਬਹੁਤ ਤਰ੍ਹਾਂ ਬਹੁਤ ਜ਼ਿਆਦਾ ਕਮੈਂਟ ਆਏ ਜਿਸ ਕਰਕੇ ਮੈਨੂੰ ਹੋਰ ਉਤਸ਼ਾਹ ਮਿਲਿਆ ਮੈਂ ਹੋਰ ਸਬਜ਼ੀਆਂ ਹੋਰ ਬੜਾ ਤਰ੍ਹਾਂ ਦੇ ਖਾਣੇ ਬਣਾਉਣੇ ਸ਼ੁਰੂ ਕਰ ਦਿੱਤੇ ਜਿਸ ਤਰ੍ਹਾਂ ਨਾਲ ਮੈਨੂੰ ਬਹੁਤ ਹੀ ਤਜ਼ਰਬਾ ਹਾਸਿਲ ਹੋਇਆ ਔਰ ਮੈਨੂੰ ਖੁਸ਼ੀ ਆ ਕਿ ਮੈਂ ਬਹੁਤ ਕੁਛ ਇਸ ਚੀਜ਼ ਤੋਂ ਸਿੱਖਿਆ ਕਰੋਨਾ ਦੇ ਵਿੱਚ ਬਹੁਤ ਕੁਝ ਸਿੱਖਿਆ ਜਿਸ ਕਰਕੇ ਮੈਨੂੰ ਬਹੁਤ ਖੁਸ਼ੀ ਹੋਈ ਮੈਨੂੰ ਬਹੁਤ ਹੀ ਜ਼ਿਆਦਾ ਆਪਣੇ 'ਤੇ ਮਾਣ ਕਹਿ ਸਕਦੇ ਹੋ ਕਿ ਮਾਣ ਹੋਇਆ ਕਿ ਮੈਂ ਇਸ ਚੀਜ਼ ਨੂੰ ਬਣਾਉਣ ਦੇ ਲਈ ਮੈਨੂੰ ਮੇਰੇ ਕੁਝ ਮੇਰੇ ਵਿੱਚ ਕੁਛ ਤਜ਼ਰਬਾ ਹੈ ਕਿ ਮੈਂ ਇਹ ਚੀਜ਼ਾਂ ਨੂੰ ਬਣਾ ਕੇ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਉਹਨਾਂ ਨੂੰ ਦੱਸ ਸਕਾਂ ਕਿ ਕਿਸ ਤਰ੍ਹਾਂ ਨਾਲ ਕਈ ਤਰ੍ਹਾਂ ਦੇ ਨਾਲ ਮੈਨੂੰ ਇਸ ਚੀਜ਼ ਨੂੰ ਲੈ ਕੇ ਮੈਨੂੰ ਫੋਨ ਆਏ ਕਿ ਮੈਨੂੰ ਬੜਿਆ ਬੜਿਆਂ ਨੇ ਬਹੁਤ ਕੁਝ ਇਸ ਦੇ ਬਾਰੇ ਪੁੱਛਦੇ ਤਜ਼ਰਬੇ ਬਾਰੇ ਤੁਸੀਂ ਕਿਸ ਤਰ੍ਹਾਂ ਬਣਾਇਆ ਕੀ ਕੀਤਾ ਕਿਸ ਤਰ੍ਹਾਂ ਇਸ 'ਤੇ ਇ ਮੈਂ ਬਹੁਤ ਲੋਕਾਂ ਨਾਲ ਲੋਕਾਂ ਨੂੰ ਬਹੁ ਲੋਕਾਂ ਦੀ ਬਹੁਤ ਮਦਦ ਕੀਤੀ ਇਸ ਦੇ ਵਿੱਚ ਉਹਨਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਬਣਾਉਣੇ ਹਨ ਮੈਨੂੰ ਖਾਣਾ ਬਣਾਉਣ ਦਾ ਬਹੁਤ ਹੀ ਸ਼ੌਂਕ ਹੈ ਜਿਸ ਕਰਕੇ ਮੈਨੂੰ ਇਹ ਮੌਕਾ ਮਿਲਿਆ ਕਰੋਨਾ ਦੇ ਵਿੱਚ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਣ ਦਾ ਜਿਸ ਦੇ ਨਾਲ ਮੈਨੂੰ ਹੋਰ ਵੀ ਬਹੁਤ ਕੁਛ ਸਿੱਖਣ ਨੂੰ ਮਿਲਿਆ ਔਰ ਕਈ ਤਰ੍ਹਾਂ ਮੈਂ ਹੋਰ ਵੀ ਸਿੱਖਿਆ ਕਈਆਂ ਤੋਂ ਮੈਂ ਵੀ ਕਈਆਂ ਤੋਂ ਵੀ ਸਿੱਖਿਆ ਕੁਛ ਕਿ ਕਿਸ ਤਰ੍ਹਾਂ ਹੋਰ ਚੀਜ਼ਾਂ ਵੀ ਕਿੱਦਾਂ ਬਣਾਉਣੀਆਂ ਹਨ ਕਿ ਜਿਸ ਤਰ੍ਹਾਂ ਮੈਂ ਕੇਕ ਬੇਕਰੀਆਂ ਬੇਕਰੀ ਦੀਆਂ ਚੀਜ਼ਾਂ ਜਿਸ ਤਰ੍ਹਾਂ ਕਹਿ ਲਉ ਕਿ ਇੱਕ ਬਿਸਕਿਟਸ ਹੋਰ ਬਹੁਤ ਤਰ੍ਹਾਂ ਦੇ ਬੇਕਸ ਕਰੇ ਜਿਹਨਾਂ ਦੇ ਨਾਲ ਮੈਨੂੰ ਹੋਰ ਵੀ ਤਜ਼ਰਬਾ ਮਿਲਿਆ ਮੈਂ ਮੈਨੂੰ ਆਪਣੇ 'ਤੇ ਬਹੁਤ ਮਾਣ ਹੈ ਧੰਨਵਾਦ